ਮੈਨੂੰ ਪੰਛੀ ਬਹੁਤ ਹੀ ਸੋਹਣੇ ਲੱਗਦੇ ਹਨ ਅਤੇ ਮੈਂ ਉਹਨਾਂ ਨੂੰ ਦੇਖ ਕੇ ਬੜੀ ਹੀ ਖੁਸ਼ ਹੁੰਦੀ ਹਾਂ ਸਵੇਰੇ ਸਾਜਰੇ ਉੱਠ ਕੇ ਮੈਂ ਬਾਹਰ ਜਾਂਦੀ ਹਾਂ ਅਤੇ ਪੰਛੀਆਂ ਦੀ ਆਵਾਜ਼ਾਂ ਸੁਣਦੀ ਹਾਂ ਅਤੇ ਉਹਨਾਂ ਨੂੰ ਉਹਲੇ ਹੋ ਕੇ ਇੱਕ ਜਗ੍ਹਾ ਤੋਂ ਦੇਖਦੀ ਹਾਂ ਜ਼ਿਆਦਾਤਰ ਪੰਛੀ ਥੋੜ੍ਹੇ ਜੰਗਲਾਂ ਵਿੱਚ ਮਿਲਦੇ ਹਨ ਮੈਂ ਇੱਕ ਦਰੱਖਤ ਦੇ ਪਿੱਛੇ ਖੜੀ ਹੋ ਕੇ ਉਹਨਾਂ ਵੱਲ ਟਿਕ ਟਿਕੀ ਲਗਾ ਕੇ ਦੇਖਦੀ ਰਹਿਦੀ ਹਾਂ ਕਿ ਉਹ ਕੀ ਕਰ ਰਹੇ ਹਨ ਪਹਿਲਾਂ ਤਾਂ ਮੈਂ ਦੇਖਦੀ ਹਾਂ ਇੱਕ ਪੰਛੀ ਇੱਕ ਪੰਛੀ ਇੱਕ ਦੂਜੇ ਨੂੰ ਚੁੰਝਾਂ ਤੇ ਚੁੰਝਾਂ ਮਾਰਦੇ ਹਨ ਅਤੇ ਇੱਕ ਪੰਛੀ ਕਿੱਦਾਂ ਤਿਨਕਾ ਤਿਨਕਾ ਚੁੱਕ ਕੇ ਦਾਣਾ ਚੁਗ ਚੁਗ ਕੇ ਇਕੱਠੇ ਕਰ ਰਹੇ ਹਨ ਕੋਈ ਘਾਸ ਲਿਆ ਰਿਹਾ ਹੈ ਕੋਈ ਇੱਕ ਦੂਜੇ ਨੂੰ ਚੁੰਝਾਂ ਮਾਰ ਰਹੇ ਹਨ ਕੋਈ ਨਿੱਕੇ ਨਿੱਕੇ ਕਰਕੇ ਘਾਹ ਲੈ ਕੇ ਆ ਰਹੇ ਹਨ ਗਰਾਵਿਤ ਤਰੀਕਿਆਂ ਦੀ ਤੁਲਨਾ ਕਰਦੇ ਹਨ ਇਕ ਵਿਅਕਤੀ ਦੀ ਦ੍ਰਿਸ਼ਟੀ ਸੰਪੂਰਨ ਹੈ ਅਤੇ ਉਹ ਜੰਗਲ ਦਾ ਖੇਤਰ ਵਿੱਚ ਪੰਛੀਆਂ ਦੇ ਰੰਗ ਅਤੇ ਅਕਾਰ ਦੀ ਪਹਿਚਾਣ ਕਰਦੇ ਹਨ ਉੱਥੇ ਅੰਨੇ ਲੋਕਾਂ ਲਈ ਇਹ ਇੱਕ ਅਲੱਗ ਦਰਜਾ ਹੁੰਦਾ ਹੈ ਉਹਨਾਂ ਲੋਕਾਂ ਲਈ ਪੰਛੀ ਦੇਖਣ ਦੇ ਤਰੀਕੇ ਹੋਰ ਲੋਕਾਂ ਦੇ ਵੱਖਰੇ ਹਨ ਉਹ ਆਮ ਤੌਰ 'ਤੇ ਧੁਨੀਆਂ ਪੰਛੀਆਂ ਦੀਆਂ ਆਵਾਜ਼ਾਂ ਅਤੇ ਸੁਗੰਧੀ ਗੰਦੇ ਦੀਆਂ ਸਮਾਜ ਵਿੱਚ ਤਰੀਕੇ ਨਾਲ ਟਕੀ ਜਾਂਦੀ ਹੈ